ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਹਾਂ ਹਾਂਜੀ ਤੁਸੀਂ ਅਰਸ਼ਦੀਪ ਕੌਰ ਬੋਲ ਰਹੇ ਹੋ ਜੀ ਹਾਂਜੀ ਭੈਣ ਜੀ ਅਸੀਂ ਜੀ ਕੈਨੇਡਾ ਤੋਂ ਆਏ ਸੀ ਜੀ ਤੁਹਾਡੇ ਐੱਨ ਆਰ ਆਈ ਜਿਹੜੇ ਕੋਲ਼ ਰਹਿੰਦੇ ਨੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਦੱਸੋ ਜੀ ਸਾਨੂੰ ਹੋ ਗਏ ਜੀ ਦਸ ਕ ਦਿਨ ਆਇਆ ਨੂੰ ਹਾਂਜੀ ਹਾਂਜੀ ਅਸੀਂ ਘੁੰਮਣ ਆਏ ਸੀ ਜੀ ਹੁਣ ਕਿਉਂਕਿ ਸ਼ੁਰੂ ਤੋਂ ਤਾਂ ਅਸੀਂ ਦੇਖੋ ਜੀ ਕੈਨੇਡਾ ਹੀ ਰਹਿੰਦੇ ਹਾਂ ਅਤੇ ਹੁਣ ਸਾਨੂੰ ਐਨਾ ਨਵਾਂਸ਼ਹਿਰ ਬਾਰੇ ਪਤਾ ਨੀ ਹੈਗਾ ਜੀ ਤੇ ਬੱ ਹਾਂਜੀ ਬੱਚੇ ਕਹਿੰਦੇ ਜੀ ਦੇਖੋ ਅਸੀਂ ਗੁਰਦੁਆਰੇ ਸਾਹਿਬ ਜਿੰਨੇ ਗੁਰਦੁਆਰੇ ਸਾਹਿਬ ਹੈ ਨਵਾਂਸ਼ਹਿਰ ਵਿੱਚ ਉਹਨਾਂ ਦੇ ਉੱਥੇ ਜਾਣਾ ਹੈ ਜੀ ਮੱਥਾ ਟੇਕਣ ਘੁੰਮਣ ਜਾਣਾ ਅਤੇ ਹਾਂਜੀ ਤੁਸੀਂ ਸਾਨੂੰ ਥੋੜੀ ਜਿਹੀ ਦੱਸਦੋ ਜੀ ਤੁਹਾਡੀ ਥੋੜੀ ਜਿਹੀ ਹੈਲਪ ਕਰਦੋ ਕਿਹੜੇ ਕਿਹੜੇ ਗੁਰਦੁਆਰੇ ਸਾਹਿਬ ਨੇ ਨਵਾਂਸ਼ਹਿਰ 'ਚ ਜੀ ਹਾਂਜੀ ਹਾਂਜੀ ਕਿੱਧਰਲੀ ਸਾਈਡ ਹੈ ਜੀ ਇਹ ਠੀਕ ਹੈ ਜੀ ਠੀਕ ਹੈ ਜੀ ਏ ਇਹ ਕਿਸ ਸਾਈਡ ਹੈ ਜੀ ਠੀਕ ਹੈ ਜੀ ਅੱਛਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੋਈ ਨਾ ਜੀ ਸਾਨੂੰ ਹੁਣੇ ਨਾਮ ਪਤਾ ਚੱਲ ਗਏ ਅਸੀਂ ਗੂਗਲ ਤੋਂ ਮੈਪ ਲਾ ਕੇ ਚੱਲ ਜਾਵਾਂਗੇ ਜੀ ਜੇ ਨਹੀਂ ਪਤਾ ਚੱਲਿਆ ਤੁਹਾਨੂੰ ਦੁਆਰਾ ਫ਼ੋਨ ਕਰਲਵਾਂਗੇ ਜੀ ਠੀਕ ਹੈ ਭੈਣ ਜੀ ਬਹੁਤ ਬਹੁਤ ਧੰਨਵਾਦ ਜੀ